ਹੈਲੋ ਨਮਸਤੇ ਹਾਂਜੀ ਨਮਸਤੇ ਜੀ ਤੁਸੀਂ ਪੰਜਾਬ ਤੋਂ ਬੋਲਦੇ ਹੋ ਜੀ ਅੱਛਿਆ ਜੀ ਅਸੀਂ ਨਾ ਮੁੰਬਈ ਤੋਂ ਬੋਲਦੇ ਹਾਂ ਅਸੀਂ ਆਪਣੇ ਪਰਿਵਾਰ ਨਾਲ ਪੰਜਾਬ 'ਚ ਆਉਣਾ ਹੈ ਅਤੇ ਮਤਲਬ ਤੁਹਾਡੇ ਤੁਹਾਡੇ ਤੋਂ ਪੁੱਛਣਾ ਸੀ ਵੀ ਪੰਜਾਬ 'ਚ ਵੀ ਕਿਹੜੀਆਂ ਚੀਜ਼ਾਂ ਨੇ ਦੇਖਣ ਵਾਸਤੇ ਅਸੀਂ ਆਉਣਾ

ਹਾਂਜੀ

ਅੱਛਿਆ ਜੀ ਹਾਂਜੀ ਅੱਛਿਆ ਜੀ ਹੋਰ ਹੋਰ ਕਿਹੜੇ ਆ ਪੰਜਾਬ 'ਚ ਆਪਣੇ ਦੇਖਣ ਲਾਇਕ ਅੱਛਿਆ ਜੀ ਉਹ ਕਿਹੜੇ ਸ਼ਹਿਰ 'ਚ ਮਿਲਦੇ ਹੈ ਜੀ ਹਾਂਜੀ ਠੀਕ ਹੈ ਜੀ ਅਤੇ ਜੁੱਤੀ ਅਤੇ ਪਰਾਂਦੀ ਫੁਲਕਾਰੀ ਇਹ ਕਿੱਥੋਂ ਮਿਲੇਗੀ ਅੱਛਿਆ ਜੀ

ਠੀਕ ਹੈ ਜੀ ਹੋਰ ਹਾਂਜੀ ਅਸੀਂ ਆਵਾਂਗੇ ਬਸ ਦੇਖਦੇ ਹਾਂ ਤਿਆਰੀ ਕਰ ਰਹੇ ਹੈਂਗੇ ਆਉਣ ਦੀ ਤਾਂ ਹੀ ਪੁੱਛ ਰਹੇ ਸੀ ਹਾਂਜੀ ਹਾਂ ਹਾਂ ਸਾਡੇ ਬੱਚਿਆਂ ਨੂੰ ਬੜਾ ਸ਼ੌਂਕ ਹੈ ਪੰਜਾਬ ਜਾਣ ਦਾ ਵੀ ਪੰਜਾਬ 'ਚ ਜਾਣਾ ਇੱਕ ਹੋਰ ਮੈਂ ਸੁਣਿਆ ਵੀ ਇੱਥੇ ਵੀ ਦੁੱਖ ਨਿਵਾਰਨ ਸਾਹਿਬ ਹੈ ਪਟਿਆਲੇ ਕਾਲੀ ਦੇਵੀ ਦਾ ਮੰਦਰ ਹੈ ਹਾਂਜੀ ਇੱਥੇ ਖ਼ਾਸ ਤਿਉਹਾਰ ਦੁੱਖ ਨਿਵਾਰਨ ਸਾਹਿਬ ਕਿਹੜਾ ਮਨਾਉਂਦੇ ਹੈ ਜਿਵੇਂ ਪੰਚਮੀ ਵਗੈਰਾ ਇੱਥੇ ਕਹਿ ਰਹੇ ਨੇਗੇ ਵੀ ਬਹੁਤ ਲੋਕਾਂ ਦੀ ਮਾਨਤਾ ਵੀ ਪੰਚਮੀ ਹੈਂ ਠੀਕ ਹੈ ਜੀ ਓਕੇ